ਸਮੇਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਵਿੱਚ ਬਹੁਤ ਬਦਲਾਵ ਆਇਆ ਹੈ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਖਾਣ ਪੀਣ ਰਹਿਣ ਸਹਿਣ ਇਮਾਰਤਾਂ ਪਹਿਰਾਵੇ ਇਹਨਾਂ 'ਚ ਉਹਨਾਂ ਦਾ ਪ੍ਰਭਾਵ ਸੀ ਅਤੇ ਬਹੁਤ ਹੀ ਬਦਲਾਵ ਸੀ ਪਰ ਜਦੋਂ ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਹਦੇ 'ਚ ਵੀ ਗਹਿਰਾ ਅਸਰ ਹੋਇਆ ਅਤੇ ਬਦਲਾਵ ਹੋਇਆ ਅੰਗਰੇਜ਼ਾਂ ਦੇ ਆਉਣ ਨਾਲ ਖਾਣ ਪੀਣ ਰਹਿਣ ਸਹਿਣ ਪਹਿਰਾਵੇ ਵਿੱਚ ਵੀ ਕਾਫੀ ਬਦਲਾਵ ਵੇਖਣ ਨੂੰ ਮਿਲਿਆ